ਮੈਂ ਆਪਣੇ ਘਰ ਨੂੰ ਡੈਕੋਰੇਸ਼ਨ ਦੇਣ ਲਈ ਇੱਕ ਚਿੱਤਰ ਬਣਾਇਆ ਸੀ ਜਿਸ ਨੂੰ ਬਣਾਉਣ ਸਮੇਂ ਮੈਨੂੰ ਬਹੁਤ ਹੀ ਕਠਿਨਾਈਆਂ ਦਾ ਸਾਹਮਣਾ ਕਰਨਾ ਪਿਆ ਸੀ ਚਿੱਤਰ ਬਣਾਉਣ ਦੇ ਸਮੇਂ ਜਦੋਂ ਮੈਂ ਚਿੱਤਰ ਬਣਾ ਕੇ ਤਿਆਰ ਕੀਤਾ ਤਾਂ ਕੁਝ ਗੁਆਂਢੀਆਂ ਦੇ ਬੱਚੇ ਸਾਡੇ ਘਰ ਆਏ ਅਤੇ ਉਹਨਾਂ ਨੇ ਬਣਾਏ ਹੋਏ ਚਿੱਤਰ ਉੱਤੇ ਕੁਝ ਪਾਣੀ ਦੀਆਂ ਬੂੰਦਾਂ ਅਤੇ ਕਲਰ ਪੇਂਟ ਖਿਲਾਰ ਦਿੱਤੇ ਜਿਸਨੂੰ ਉਹ ਸਮੇਟਨ ਵਿੱਚ ਮੈਨੂੰ ਬਹੁਤ ਹੀ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਪੇਂਟ ਗਿਰਨ ਦੇ ਕਾਰਨ ਮੇਰੀ ਚਿੱਤਰਕਾਰੀ ਪੂਰੀ ਖਰਾਬ ਹੋ ਚੁੱਕੀ ਸੀ ਜਿਸ ਕਾਰਨ ਜਿਸ ਕਾਰਨ ਮੈਂ ਉਸ ਨੂੰ ਬੜੀ ਮੁਸ਼ਕਿਲ ਨਾਲ ਰੰਗ ਅਤੇ ਹੋਰ ਅਤੇ ਹੋਰ ਡੈਕੋਰੇਸ਼ਨ ਦੇ ਸਮਾਨ ਨਾਲ ਉਸ ਨੂੰ ਸ਼ਿੰਗਾਰਿਆ ਪਰ ਉਹ ਚਿੱਤਰਕਾਰੀ ਮੈਂ ਆਪਣੇ ਆਪ ਹੀ ਸਮੇਟ ਕੇ ਉਸ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਤਿਆਰ ਕੀਤਾ ਅਤੇ ਉਹ ਪੇਂ ਉਹ ਚਿੱਤਰਕਾਰੀ ਹੁਣ ਮੇਰੇ ਘਰ ਵਿੱਚ ਘਰ ਵਿੱਚ ਲੱਗੀ ਹੋਈ ਹੈ ਅਤੇ ਬਹੁਤ ਹੀ ਵਧੀਆ ਲੱਗਦੀ ਹੈ